ਯੋਗਾ ਸ ਕਸਰਤ ਦਾ ਇੱਕ ਰੂਪ ਹੈ ਜੋ ਕਿ ਪ੍ਰਾਚੀਨ ਕਾਲ ਤੋਂ ਚੱਲਦਾ ਆ ਰਿਹਾ ਯੋਗਾ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ ਜੋ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਕਰ ਰਿਹਾ ਪਰ ਅੱਜ ਦੀ ਪੀੜ੍ਹੀ ਦੀ ਗੱਲ ਕਰਾਂ ਅੱਜ ਦੀ ਪੀੜ੍ਹੀ ਬਹੁਤ ਸੋਹਲ ਹੋ ਚੁੱਕੀ ਹੈ ਹਰ ਸਿਸਟਮ ਹੈ ਜਿਹੜਾ ਉਹ ਬਹੁਤ ਨ ਨਜ਼ਦੀਕੀ ਨਾਲ ਮਿਲ ਰਿਹਾ ਅਤੇ ਅਗਰ ਮੈਂ ਗਰਮੀ ਦੀ ਗੱਲ ਕਰਾਂ ਤਾਂ ਅਸੀਂ ਏਸੀਆਂ ਦੇ ਏਸੀਆਂ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਤਾਂ ਸਾਡੀ ਜ਼ਿੰਦਗੀ ਹੈ ਜਿਹੜੀ ਏਸੀਆਂ ਨੇ ਵੀ ਸੋਹਲ ਕਰ ਰਹੀ ਹੈ ਸਾਡਾ ਖਾਣ ਪੀਣ ਆ ਜਿਹੜਾ ਉਹ ਵਿਗੜ ਗਿਆ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਹਾਂ ਤਾਂ ਸਾਨੂੰ ਉਸ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਯੋਗਾ ਦੀ ਬਹੁਤ ਲੋੜ ਹੈ ਮੈਂ ਤਾਂ ਇਹੀ ਪੁਆਇੰਟ ਦੇਣਾ ਚਾਹੁੰਦੀ ਹਾਂ ਵੀ ਸਕੂਲ ਵਿੱਚ ਇੱਕ ਸਿਲੇਬਸ ਵਿੱਚ ਅਧਿਆਪਕ ਵੀ ਹੋਵੇ ਯੋਗਾ ਟੀਚਰ ਹੋਵੇ ਅਤੇ ਬੱਚਿਆਂ ਨੂੰ ਵੀ ਕੰਪਲਸਰੀ ਯੋਗਾ ਜਿਹੜਾ ਕਰਵਾਇਆ ਜਾ ਸਕੇ ਤਾਂ ਕਿ ਨੌਜਵਾਨਾਂ ਨੂੰ ਵੀ ਰੋ ਰੁਜ਼ਗਾਰ ਕਰਕੇ ਕਿਉਂਕਿ ਜ ਜੇ ਪੋਲਿਊਸ਼ਨ ਦੀ ਮੈਂ ਗੱਲ ਕਰਾਂ ਪੂਰੇ ਵਰਲਡ ਦੇ ਵਿੱਚ ਤਾਂ ਇੰਡੀਆ ਇੱਕ ਇਹੋ ਜਿਹਾ ਹੈ ਸਟੇਟ ਹੈ ਜੋ ਕਿ ਪੋਲਿਊਸ਼ਨ ਨਾਲ ਵਿਗੜ ਚੁੱਕੀ ਹੈ ਇਸ ਲਈ ਸਰਕਾਰ ਨੇ ਇਸ ਪੋਲਿਊਸ਼ਨ ਨੂੰ ਘਟਾਉਣ ਲਈ ਜਿਹੜਾ ਇੱਕੀ ਜੂਨ ਦਾ ਯੋਗਾ ਦਿਸ ਦਿਵਸ ਡੇ ਮਨਾਇਆ ਜਾਂਦਾ ਹੈ ਤਾਂ ਸਾਨੂੰ ਯੋਗਾ ਦੀ ਬਹੁਤ ਲੋੜ ਹੈ ਤਾਂ ਤਾਂ ਕਿ ਕੰਪਲਸਰੀ ਸਿਲੇਬਸ ਦੇ ਵਿੱਚ ਲਗਾਇਆ ਜਾ ਸਕੇ ਅਤੇ ਸਾਨੂੰ ਅਸੀਂ ਬਿਮਾਰੀਆਂ ਤੋਂ ਬਚ ਸਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ